ਹੈਲੋ ਹਾਂਜੀ ਭਾਅ ਜੀ ਕੀ ਹਾਲ ਚਾਲ ਹੈ ਭਾਅ ਜੀ ਅਸੀਂ ਨਵਾਂ ਸ਼ਹਿਰ ਤੋਂ ਬੋਲਦੇ ਹਾਂ ਚਾਰ ਸੌ ਬਾਰਾਂ ਨੰਬਰ 'ਚ ਮਕਾਨ 'ਚੋਂ ਅਤੇ ਭਾਅ ਜੀ ਅਸੀਂ ਨਾ ਤੁਹਾਡੇ ਕੋਲ ਕੱਲ੍ਹ ਓਲਾ 'ਤੇ ਨਾ ਕੈਬ ਬੁਕ ਕੀਤੀ ਸੀ ਅਤੇ ਨਾ ਅਸੀਂ ਕੱਲ੍ਹ ਨਿਕਲਣਾ ਸੀ ਅੰਮ੍ਰਿਤਸਰ ਨੂੰ ਅਤੇ ਭਾਅ ਜੀ ਸਾਡੇ ਨਾ ਅੱਜ ਘਰ ਸਾਡੀ ਚਾਚੀ ਦੇ ਰਿਸ਼ਤੇਦਾਰੀ ਦੇ ਡੈਥ ਹੋ ਗਈ ਸਾਡੇ ਅਤੇ ਇਸ ਕਰਕੇ ਅਸੀਂ ਹੁਣ ਸਾਡਾ ਪ੍ਰੋਗਰਾਮ ਕੈਂਸਲ ਹੋ ਗਿਆ ਉੱਧਰ ਜਾਣ ਦਾ ਅਤੇ ਬਾਕੀ ਭਾਅ ਜੀ ਤੁਹਾਨੂੰ ਅਸੀਂ ਪੇਮੈਂਟ ਕੀਤੀ ਸੀਗੀ ਹਾਫ ਪੇਮੈਂਟ ਕੀਤੀ ਸੀਗੀ ਫਿਫਟੀ ਪ੍ਰਸੈਂਟ ਅਤੇ ਬਾਕੀ ਭਾਈ ਤੁਹਾਨੂੰ ਹੱਥ ਜੋੜ ਕੇ ਸਾਡੀ ਬੇਨਤੀ ਹੈ ਵੀ ਦੱਸ ਦਿਓ ਵੀ ਅਸੀਂ ਕਿਸੇ ਕਾਰਨ ਹੁਣ ਜਾ ਨਹੀਂ ਸਕਦੇ ਉੱਥੇ ਅੰਮ੍ਰਿਤਸਰ ਅਤੇ ਬਾਕੀ ਦੱਸ ਦਿਓ ਸਾਨੂੰ ਵੀ ਸਾਡੀ ਪੇਮੈਂਟ ਸਾਨੂੰ ਫਿਫਟੀ ਪ੍ਰਸੈਂਟ ਕ ਵਾਪਸ ਕਰਤੀ ਜਾਵੇ ਜਾਂ ਤਾਂ ਕੈਸ਼ ਕਰਨੀ ਕੈਸ਼ ਕਰ ਦਿਓ ਔਨਲਾਈਨ ਕਰਨਾ ਔਨਲਾਈਨ ਕਰ ਦਿਓ ਪੇਅਟੀਐੱਮ ਕਰ ਦਿਓ ਗੂਗਲ ਪੇਅ ਕਰ ਦਿਓ ਜੇ ਬੈਂਕ 'ਚ ਕਰਨੀ ਆ ਤਾਂ ਤੁਹਾਨੂੰ ਅਸੀਂ ਮੈਂ ਆਪਣਾ ਬੈਂਕ ਅਕਾਊਂਟ ਨੰਬਰ 'ਤੇ ਆਈ ਐਫ ਸੀ ਕੋਡ ਭੇਜ ਦੂਗਾ ਅਤੇ ਦੱਸ ਦਿਓ ਭਾਅ ਜੀ ਕਿੱਦਾਂ ਪੇਮੈਂਟ ਕਰਨੀ ਆ ਉੱਦਾਂ ਕਰ ਦਿਓ ਇਹ ਬਹੁਤ ਮਿਹਰਬਾਨੀ ਤੁਹਾਡੀ